ਜੀ ਹਾਂ ਮੇਰੇ ਕੋਲ ਨਿੱਜੀ ਇੱਛਾ ਦੀ ਇੱਛਾਵਾਂ ਹਨ ਜਿਹਦੇ ਨਾਲ ਮੈਂ ਆਪਣਾ ਕੰਮ ਕਰਨਾ ਚਾਹੁੰਦੀ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪੂਰਵਕ ਬਿਊਟੀਸ਼ੀਅਨ ਬਣਨਾ ਚਾਹੁੰਦੀ ਹਾਂ ਅਤੇ ਮੈਂ ਆਪਣਾ ਸਫਲਤਾ ਪੂਰਵਕ ਬਿਜ਼ਨਿਸ ਸ਼ੁਰੂ ਕਰਨਾ ਚਾਹੁੰਦੀ ਹਾਂ